ਸ਼ਗਨ ਸਕੀਮ ਇਹ ਸ ਬਹੁਤ ਸਾਰੀਆਂ ਇੱਦਾਂ ਦੀਆਂ ਸਕੀਮਾਂ ਨੇ ਜੋ ਸਰਕਾਰ ਨੇ ਚਲਾਈਆਂ ਹੋਈਆਂ ਨੇ ਅਤੇ ਜੋ ਬਹੁਤ ਵਧੀਆ ਗੱਲ ਹੈ ਇਹਨਾਂ ਵਿੱਚੋਂ ਜਿਹੜੀ ਮੈਂ ਉਹ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਤੇ ਇੱਕ ਨੀਲੇ ਕਾਰਡ 'ਤੇ ਜਿਹੜਾ ਰਾਸ਼ਨ ਮਿਲਦਾ ਉਹਨਾਂ ਦੋਨਾਂ ਯੋਜਨਾ ਯੋਜਨਾ ਦਾ ਲਾਭ ਲੈ ਰਹੀ ਹਾਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਸਾਨੂੰ ਡੇਢ ਲੱਖ ਰੁਪਈਆ ਆਇਆ ਸੀ ਜਿਸ ਨਾਲ ਅਸੀਂ ਆਪਣਾ ਘਰ ਬਣਾਇਆ ਹੈ ਅਤੇ ਇਸ ਤੋਂ ਇਲਾਵਾ ਜਿਹੜੇ ਨੀਲੇ ਕਾਰਡ ਹੈ ਰਾਸ਼ਨ ਮਿਲਦਾ ਹੈ ਉਹ ਅਸੀਂ ਲੈ ਕੇ ਆਉਂਦੇ ਹਾਂ ਹਰੇਕ ਮਹੀਨੇ ਮਿਲਦਾ ਹੈ ਟੋ ਹੁਣ ਟੋਕਨ 'ਤੇ ਮਿਲਣ ਲੱਗ ਗਿਆ ਹੈ ਪਹਿਲਾਂ ਉਹ ਐਦੇ ਮਿਲਦਾ ਸੀ ਹੁਣ ਪਰਚੀ ਕਟਾਉਣੀ ਪੈਂਦੀ ਹੈ ਅਤੇ ਹੁਣ ਥੰਮ ਇੰਪ੍ਰੈਸ਼ਨ ਵੀ ਲੱਗਣ ਲੱਗ ਗਿਆ ਹੁਣ ਇਸ ਤ ਪਹਿਲਾਂ ਤਾਂ ਕੋਈ ਵੀ ਕਿਸੇ ਨਾਮ 'ਤੇ ਕੋਈ ਵੀ ਲੈ ਜਾਂਦਾ ਸੀ ਰਾਸ਼ਨ ਹੁਣ ਇਸ ਤਰ੍ਹਾਂ ਨਹੀਂ ਹੁੰਦਾ ਹੁਣ ਪਹਿਲਾਂ ਇੱਕ ਥੰਮ ਇੰਪ੍ਰੈਸ਼ਨ ਲੱਗਦਾ ਹੈ ਫਿਰ ਉਸ ਤੋਂ ਬਾਅਦ ਸਾਨੂੰ ਜਿਸ ਬੰਦੇ ਦਾ ਨਾਮ ਹੈ ਉਸ ਬੰਦੇ ਦੇ ਨਾਮ 'ਤੇ ਫਿਰ ਉਹ ਰਾਸ਼ਨ ਉਸਨੂੰ ਮਿਲਦਾ ਇੱਕ ਪਰਚੀ ਕੱਟੀ ਜਾਂਦੀ ਹੈ ਅਤੇ ਉਸ ਬੰਦੇ ਨੂੰ ਨਾਮ 'ਤੇ ਮਿਲਦਾ ਇਹ ਬਹੁਤ ਵਧੀਆ ਯੋਜਨਾ ਹੈ ਤਾਂ ਕਿ ਜਿਹੜੇ ਗਰੀਬ ਲੋਕ ਹੈ ਉਹਨਾਂ ਦੀ ਮਦਦ ਹੋ ਸਕੇ ਕਿਵੇਂ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਘਰ ਕੋਈ ਇੱਦਾਂ ਦਾ ਨਹੀਂ ਬੰਦਾ ਹੈ ਜੋ ਕਮਾ ਸਕੇ ਉਹ ਗਰੀਬ ਨੇ ਉਹ ਅਨਪੜ੍ਹ ਨੇ ਉਹਨਾਂ ਦੇ ਘਰ ਕੋਈ ਨਹੀਂ ਕੋਈ ਬਜ਼ੁਰਗ ਨੇ ਉਹਨਾਂ ਦੀ ਇਸ ਤਰ੍ਹਾਂ ਫਿਰ ਜਿਹੜੀਆਂ ਇਹ ਯੋਜਨਾਵਾਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਹੋ ਗਈ ਨੀਲੇ ਕਾਰਡ ਅਤੇ ਰਾਸ਼ਨ ਦੀ ਯੋਜਨਾ ਹੋ ਗਈ ਮਨਰੇਗਾ ਯੋਜਨਾ ਹੋ ਗਈ ਅਤੇ ਇਸੇ ਤਰ੍ਹਾਂ ਪੀਲੇ ਕਾਰਡ ਹੋ ਗਏ ਇਸੇ ਤਰ੍ਹਾਂ ਹੁਣ ਆਯੁਸ਼ਮਾਨ ਕਾਰਡ ਬਣਨ ਲੱਗ ਗਏ ਉਹ ਵੀ ਸਾਰਿਆਂ ਦੇ ਬਣਨ ਲੱਗ ਗਏ ਅਤੇ ਇਹਦੇ ਵੀ ਅਸੀਂ ਲਾਭ ਲੈ ਰਹੇ ਹਾਂ ਇਹਦੇ ਨਾਲ ਸਾਡਾ ਇਲਾਜ ਜਿਹੜਾ ਉਹ ਪੰਜ ਲੱਖ ਤੱਕ ਹਸਪਤਾਲਾਂ ਵਿੱਚ ਫ੍ਰੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ ਜੇ ਕਿਸੇ ਨੂੰ ਬਹੁਤ ਵੱਡੀ ਬਿਮਾਰੀ ਹੈ ਤਾਂ ਫਿਰ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਉਹਨਾਂ ਦਾ ਤਾਂ ਖਰਚਾ ਹੀ ਬਹੁਤ ਮਹਿੰਗਾ ਹੈ ਅਤੇ ਫਿਰ ਜੇ ਪ੍ਰਧਾਨ ਮੰਤ ਜੋ ਆ ਆਯੂਸ਼ਮਾਨ ਕਾਰਡ ਬਣੇ ਨੇ ਹੈਲਥ ਕਾਰਡ ਬਣੇ ਨੇ ਉਹਨੂੰ ਤੁਸੀਂ ਕਿਸੇ ਵੀ ਹਸਪਤਾਲ 'ਚ ਲਿਜਾ ਲੋ ਚਾਹੇ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ ਤੁਸੀਂ ਆਪਣਾ ਪੰਜ ਲੱਖ ਦਾ ਜਿਹੜਾ ਇਲਾਜ ਹੈ ਉਹ ਫ੍ਰੀ ਕਰਾ ਸਕਦੇ ਨੇ ਇਸ ਤਰ੍ਹਾਂ ਇਹਨਾਂ ਸਾਰੀਆਂ ਯੋਜਨਾਵਾਂ ਨੇ ਮੇਰੀ ਵੀ ਮਦਦ ਕੀਤੀ ਹੈ ਅਤੇ ਬਾਕੀ ਲੋਕਾਂ ਦੀ ਵੀ ਬਹੁਤ ਸਾਰੀ ਮਦਦ ਕੀਤੀ ਹੈ